ਬਾਗਬਾਨੀ ਕਰਦੇ ਸਮੇਂ ਸਾਨੂੰ ਕਈ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਗਰਮੀਆਂ ਦੇ ਮੌਸਮ ਵਿੱਚ ਪਾਣੀ ਜ਼ਿਆਦਾ ਚਾਹੀਦਾ ਏ ਅਤੇ ਜ਼ਿਆਦਾ ਧੁੱਪ ਨਹੀਂ ਲੱਗਣੀ ਚਾਹੀਦੀ ਜਦੋਂ ਸਰਦੀ ਦਾ ਮੌਸਮ ਆ ਜਾਂਦਾ ਏ ਤਾਂ ਉਦੋਂ ਧੁੱਪ ਪਾਣੀ ਥੋੜ੍ਹਾ ਘੱਟ ਦੇਣਾ ਏ ਅਤੇ ਥੋੜ੍ਹਾ ਠੀਕ ਠੀਕ ਥੋੜ੍ਹਾ ਧੁੱਪ ਦਾ ਵੀ ਜ਼ਿਆਦਾ ਧੁੱਪ ਵੀ ਨਹੀਂ ਜ਼ਿਆਦਾ ਦੇਣੀ ਜ਼ਿਆਦਾ ਗਰਮੀ ਵੀ ਨਹੀਂ ਲੱਗਣੀ ਚਾਹੀਦੀ ਉਸ ਤੋਂ ਬਾਅਦ ਜਦੋਂ ਬਰਸਾਤ ਜਦੋਂ ਬਸੰਤ ਰੁੱਤ ਆਉਂਦੀ ਹੈ ਤਾਂ ਸਮੇਂ ਸਮੇਂ ਸਿਰ ਕਟਾਈ ਕਰਨੀ ਚਾਹੀਦੀ ਹੈ ਮਿੱਟੀ ਅਤੇ ਦੇਸੀ ਰੂੜੀ ਦਾ ਖਾਸ ਕਰਕੇ ਇਸਤੇਮਾਲ ਕਰਨਾ ਚਾਹੀਦਾ ਹੈ ਉਹ ਤੋਂ ਬਾਅਦ ਜ਼ਿਆਦਾ ਸਾਨੂੰ ਖਾਦ ਦਵਾਈਆਂ ਦਾ ਵਰਤੋਂ ਨਹੀ ਕਰਨੀ ਚਾਹੀਦੀ ਸਮੇਂ ਸਮੇਂ ਸਿਰ ਇਹਨਾਂ ਦੀ ਦੇਖਭਾਲ ਕਰਦੇ ਰਹਿਣਾ ਚਾਹੀਦਾ ਏ ਗੁ਼ਡਾਈ ਕਰਦੇ ਰਹਿਣਾ ਚਾਹੀਦਾ ਏ ਜ਼ਿਆਦਾ ਖਾਦਾਂ ਸਪਰੇਆਂ ਤੋਂ ਬੱਚ ਕੇ ਰੱਖੋ ਇਹਨਾਂ ਨੂੰ ਸਮੇਂ ਸਿਰ ਦੇਸੀ ਰੂੜੀ ਖਾਦ ਵਗੈਰਾ ਦੇ ਇਸਤੇਮਾਲ ਕਰੋ ਆਹ ਸਾਨੂੰ ਬਾਗਬਾਨੀ ਕਰਨੀ ਚਾਹੀਦੀ ਹੈ ਜੋ ਕਿ ਬਹੁਤ ਵਧੀਆ ਏ ਹਰੇਕ ਲਈ ਫਾਈਦੇਮੰਦ ਹੈ ਸਮੇਂ ਪੌਦਿਆਂ ਨੂੰ ਸਮਿਆਂ ਦੇ ਹਿਸਾਬ ਨਾਲ਼ ਹੀ ਰੱਖੋ ਅਤੇ ਜ਼ਿਆਦਾ ਵਧੀਆ ਰਹੇਗਾ